ਮੈਂ ਟੈਕਨੋਲੋਜੀ ਨੂੰ ਰੋਜ਼ਾਨਾ ਕਈ ਤਰੀਕੇ ਨਾਲ ਵਰ ਵਰਤਦੀ ਹਾਂ ਹਰ ਦਿਨ ਕੰਪਿਊਟਰ ਅਤੇ ਨੈਟਵਰਕ ਦਾ ਉਪਯੋਗ ਕਰਕੇ ਮੈਂ ਵੱਖ ਵੱਖ ਇ ਵੱਖ ਵੱਖ ਇਨਫੋਰਮੇਸ਼ਨ ਨੂੰ ਲੈਂਦੀ ਹਾਂ ਇਹਦੇ 'ਤੇ ਕਈ ਤਰ੍ਹਾਂ ਦੀ ਰਿਸਰਚ ਵੀ ਕਰਦੀ ਹਾਂ ਅਤੇ ਵੱਖਰੇ ਵੱਖਰੇ ਟਾਸਕ ਨੂੰ ਵੀ ਕਰਦੀ ਹਾਂ ਟੈਕਨੋਲੋਜੀ ਨੇ ਮੇਰੀ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਹੀ ਸੁਧਾਰ ਕੀਤਾ ਹੈ ਜਿਵੇਂ ਕਿ ਸਾਨੂੰ ਬਚਾਉਣਾ ਅਤੇ ਵੱਧ ਤੋਂ ਵੱਧ ਗਿਆਨ ਲੈਣਾ ਇੱਕ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਮਿਸਾਲ ਲੈਂਦੇ ਹਾਂ ਜਦੋਂ ਇੱਕ ਦਿਵਸ ਆਪਨੇ ਰਿਸਰਚ ਦੇ ਵਿੱਚ ਲੱਗਿਆ ਹੋਇਆ ਸੀ ਤਾਂ ਟੈਕਨੋਲਜੀ ਦੀ ਮਦਦ ਨਾਲ ਮੈਂ ਮੈਂ ਇੰਟਰਨੈਟ 'ਤੇ ਵੱਖ ਵੱਖ ਸੋਰਸਿਸ ਨੂੰ ਚੈੱਕ ਕਰਕੇ ਉਹਨਾਂ ਨੂੰ ਅਪਡੇਟ ਰੱਖ ਸਕਦਾ ਹਾਂ ਇਹ ਤਰ੍ਹਾਂ ਮੇਰੇ ਕੰਮ ਵਿੱਚ ਵ ਜ਼ਿਆਦਾ ਤੋਂ ਜ਼ਿਆਦਾ ਪਲੀ ਤਬਦੀਲੀ ਬੰਦ ਜਾਂਦੀ ਹੈ ਅਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਇੰਫ਼ੋਰਮੇਸ਼ਨ ਇਕੱਠੀ ਕਰਕੇ ਉਹਨਾਂ 'ਤੇ ਇੱਕ ਚੰਗੇ ਉਹਨਾਂ 'ਤੇ ਚੰਗੇ ਮੈਨੂੰ ਰਿਜਲਟ ਮਿਲਦੇ ਨੇ ਕੁਝ ਸਾਲ ਪਹਿਲਾਂ ਹੀ ਜਿਵੇਂ ਕਿ ਕੁਝ ਸਾਲ ਪਹਿਲਾਂ ਹੀ ਇੱਕ ਆਦਮੀ ਨੇ ਆਦਮੀ ਨੇ ਟੈਕਨੋਲੋਜੀ ਦੀ ਮਦਦ ਨਾਲ ਆਪਣੇ ਇੰਟਰ ਰਿਸਰਚ ਦੀ ਸਪੀਡ ਨੂੰ ਵਧਾਇਆ ਪਿਛਲੇ ਦਿਨਾਂ ਉਹ ਆਪਣੇ ਰਿਸਰਚ ਵੀ ਰਿਸਰਚ ਪੇਪਰਸ ਦੇ ਲਈ ਫਿਜੀਕਲ ਲਾਇਬ੍ਰੇਰੀਸ ਵਿੱਚ ਜਾ ਕੇ ਕਈ ਤਰ੍ਹਾਂ ਦਾ ਸਮਾਨ ਲੈਂਦਾ ਸੀ ਆਪਦੀ ਫੋਰ ਟੈਕਨੋਲੋਜੀ ਦੇ ਰਿਲੇਟੀਡ ਜੋ ਉਸ ਨੂੰ ਉਸ 'ਤੇ ਕੰਮ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦੀ ਸੀ ਇਸ ਤਰ੍ਹਾਂ ਇਸ ਟੈਕਨੋਲੋਜੀ ਨੇ ਉਸ ਦੀ ਰੂਟੀਨ ਨੂੰ ਨੂੰ ਵਧਾਇਆ ਸੀ ਇੱਕ ਕਹਾਣੀ ਟੈਕਨੋਲੋਜੀ ਦੀ ਮਦਦ ਨਾਲ ਕਿਵੇਂ ਸੁਧਾਰੀ ਜਾ ਸਕਦੀ ਹੈ ਉਸ ਦੀ ਇੱਕ ਇਹੀ ਮਿਸਾਲ ਹੈ